ਮੇਰੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਟਰਾਂਸਪੋਰਟ ਦਾ ਸਾਧਨ ਬੱਸਾਂ ਹੀ ਹਨ ਚੰਡੀਗੜ੍ਹ ਦੇ ਨੇੜੇ ਹੋਰ ਕਾਰਨਾਂ ਕਰਕੇ ਅਤੇ ਚੰਡੀਗੜ੍ਹ ਸੀ ਟੀ ਯੂ ਦੀਆਂ ਬੱਸਾਂ ਵੀ ਆਉਂਦੀਆਂ ਹਨ ਮੇਰੇ ਪਿੰਡ ਮੇਨ ਅੱਡਾ ਬਣਿਆ ਹੋਇਆ ਅਤੇ ਇਹਦੇ ਅੱਧੇ ਅੱਧੇ ਘੰਟੇ ਬਾਅਦ ਚੰਡੀਗੜ੍ਹ ਨੂੰ ਬੱਸਾਂ ਰੋਪੜ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਜਾਂਦੀਆਂ ਰਹਿੰਦੀਆਂ ਅਤੇ ਸ਼ਾਮ ਨੂੰ ਇੱਕ ਬੱਸ ਜਾਂਦੀ ਏ ਜਿਹੜੀ ਚੰਡੀਗੜ੍ਹ ਤੋਂ ਆ ਕੇ ਮੇਰੇ ਪਿੰਡ ਤੋਂ ਅੱਗੇ ਰੋਪੜ ਤੋਂ ਆਉਂਦੀ ਹੈ ਅਤੇ ਸਵੇਰ ਟਾਈਮ ਉਹ ਹੀ ਬੱਸ ਦੁਬਾਰਾ ਉਸੇ ਰੂਟ ਨੂੰ ਆਉਂਦੀ ਹੈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹਨ ਅਤੇ ਕੁਝ ਲੋਕਾਂ ਨੇ ਆਪਣੇ ਜਿਵੇਂ ਨਿੱਜ ਨਿੱਜੀ ਸਾਧਨ ਹੈ ਉਹ ਵੀ ਟਰਾਂਸਪੋਰਟ ਦੇ ਤੌਰ 'ਤੇ ਵਰਤੇ ਜਾਂਦੇ ਹਨ ਮੋਟਰਸਾਈਕਲ ਗੱਡੀਆਂ ਅੱਜ ਕੱਲ੍ਹ ਦੇ ਸਮੇਂ ਵਿੱਚ ਸਭ ਕੋਲ ਹੀ ਮੋਟਰਸਾਈਕਲ ਗੱਡੀਆਂ ਹਨ ਬੱਸ ਅੱਡਾ ਤਾਂ ਮੇਰੇ ਪਿੰਡ ਵੀ ਹੈ ਅਤੇ ਨੇੜੇ ਸਭ ਤੋਂ ਜ਼ਿਆਦਾ ਚੰਡੀਗੜ੍ਹ ਦਾ ਆਈ ਐੱਸ ਬੀ ਟੀ ਸਤਾਰਾਂ ਵਾਲ਼ਾ ਸੈਕਟਰ ਵਾਲ਼ਾ ਪੈਂਦਾ ਹੈ ਫਲਾਈਟਾਂ ਦੇ ਤੌਰ ਤੇ ਦੇਖਿਆ ਜਾਵੇ ਏਅਰਪੋਰਟ ਚੰਡੀਗੜ੍ਹ ਵਾਲ਼ਾ ਮੋਹਾਲੀ ਸਾਡੇ ਜ਼ਿਲ੍ਹੇ ਵਿੱਚ ਨਵਾਂ ਏਅਰਪੋਰਟ ਬਣਿਆ ਮੋਹਾਲੀ ਬਾਕਰਪੁਰ ਰੋਡ 'ਤੇ ਬਣਿਆ ਹੈ ਉਹ ਇਸ ਬਹੁਤ ਹੀ ਜ਼ਿਆਦਾ ਹੁਣ ਤਾਂ ਸਮੇਂ ਦੇ ਨਾਲ਼ ਨਾਲ਼ ਸੜਕਾਂ ਵੀ ਵਧੀਆ ਅਤੇ ਆਵਾਜਾਈ ਦੇ ਢੰਗ ਵੀ ਬਹੁਤ ਵਧੀਆ ਹੁੰਦੇ ਜਾ ਰਹੇ ਹਨ ਚੰਡੀਗੜ੍ਹ ਦੇ ਨੇੜੇ ਹੋਣ ਕਰਕੇ ਇੱਥੇ ਬਹੁਤ ਹੀ ਜ਼ਿਆਦਾ ਵਿਕਾਸ ਹੋ ਰਿਹਾ